ਭਾਰਤ ਦੀਆਂ ਮੁੁੱਖ ਖੇਡਾਂ ਹਨ ਜਿਵੇਂ ਕਿ ਕਬੱਡੀ ਖੌ ਖੌ ਕ੍ਰਿਕੇਟ ਕੁਸ਼ਤੀ ਹਾਕੀ ਹਾਕੀ ਅਤੇ ਕਬੱਡੀ ਫੁੱਟਬਾਲ ਇਹ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਭਾਰਤ ਵਿੱਚ ਦੋ ਬਹੁਤ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਦੇਖਣ ਆਉਂਦੇ ਹਨ ਜ਼ਿਆਦਾ ਟੂਰਨਾਮੈਂਟ ਕਬੱਡੀ ਦੇ ਹੁੰਦੇ ਹਨ ਕਬੱਡੀ ਸਾਡੀ ਮਾਂ ਖੇਡ ਕਬੱਡੀ ਹੈ ਇਹ ਸਾਨੂੰ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੀ ਹੈ